ਜਾਨਵਰ ਨੂੰ ਸਭ ਤੋਂ ਪਹਿਲਾਂ ਜਦੋਂ ਅਸੀਂ ਉਹਨੂੰ ਲੈ ਕੇ ਆਉਂਦੇ ਹਾਂ ਉਸਦੀ ਅਸੀਂ ਸਭ ਸਿਹਤ ਦੇਖਦੇ ਹਾਂ ਫਿਰ ਅਸੀਂ ਉਹਨੂੰ ਚੰਗੀ ਤਰ੍ਹਾਂ ਜਦੋਂ ਸਾਨੂੰ ਅੱਛਾ ਲੱਗਦਾ ਫਿਰ ਅਸੀਂ ਜਾਨਵਰ ਲੈ ਕੇ ਆਉਂਦੇ ਹਾਂ ਫਿਰ ਉਹਦੀ ਅਸੀਂ ਲੈਣ ਤੋਂ ਬਾਅਦ ਜਦੋਂ ਘਰ ਆ ਜਾਂਦੇ ਆ ਅੱਛੀ ਤਰ੍ਹਾਂ ਉਹਦੀ ਦੇਖ ਰੇਖ ਕਰਦੇ ਹਾਂ ਉਹਨੂੰ ਚੰਗਾ ਸੰਭਾਲਦੇ ਆ ਔਰ ਸੰਭਾਲਦੇ ਆਂ ਨੂੰ ਅੱਛਾ ਖਾਣਾ ਵੀ ਦਿੰਦੇ ਹਾਂ ਪਰ ਉਹਨਾਂ ਦਾ ਅਸੀਂ ਦੁੱਧ ਯੂਜ ਕਰਦੇ ਹਾਂ ਉਹਨਾਂ ਨੂੰ ਚੰਗੀ ਪੋਸ਼ਟਿਕ ਤੱਤ ਦਿੰਦੀ ਹਾਂ ਫਿਰ ਉਹਨਾਂ ਉਹਨਾਂ ਤੋਂ ਸਾਨੂੰ ਵੀ ਕਈ ਸਾਰੀਆਂ ਪੋਸ਼ਟਿਕ ਖੁਰਾਕਾਂ ਵੀ ਮਿਲਦੀਆਂ ਜਿਵੇਂ ਦੁੱਧ ਦਹੀਂ ਮੱਖਣ ਘਿਓ ਆਦਿ ਵੀ ਮਿਲਦਾ ਹੈ ਫਿਰ ਜ ਉਹਨਾਂ ਨੂੰ ਜਿਸ ਜਿਸ ਤਰ੍ਹਾਂ ਦੀ ਅਸੀਂ ਖੁਰਾਕ ਦਿੰਦੇ ਹਾਂ ਉੱਦਾਂ ਦਾ ਹੀ ਸਾਨੂੰ ਉਹ ਦੁੱਧ ਦਿੰਦੇ ਹਨ ਫਿਰ ਇਸ ਕਰਕੇ ਅਸੀਂ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਖਿਆਲ ਰੱਖਦੇ ਹਾਂ ਅਕਸਰ ਜਦੋਂ ਵੀ ਅਸੀਂ ਉਹਨਾਂ ਨਾਲ ਸੁੱਕੇ ਗਿੱਲੇ ਔਰ ਸੁੱਕੇ ਗਿਲੇ ਦਾ ਬਹੁਤ ਧਿਆਨ ਰੱਖਦੇ ਹਾਂ ਔਰ ਉਹਨਾਂ ਤੋਂ ਸਾਨੂੰ ਜਿਹੜੀਆਂ ਅਸੀਂ ਘਰ ਵਿੱਚ ਉਹਨਾਂ ਦਾ ਗੋਬਰ ਗੋਏਆ ਗੋਬਰ ਗੋਹਾ ਹੁੰਦਾ ਉਹ ਤੋਂ ਅਸੀਂ ਪਾਥੀਆਂ ਵੀ ਤਿਆਰ ਕਰਦੇ ਹਾਂ ਔਰ ਖਾਦ ਵੀ ਤਿਆਰ ਹੁੰਦੀ ਹੈ ਉਹਨਾਂ ਤੋਂ ਜਦੋਂ ਚੰ ਖਾਦਾਂ ਦਾ ਔਰ ਉਹਨਾਂ ਦੀ ਦੁ ਖਾਦਾਂ ਦਾ ਖਾ ਖਿਆਲ ਰੱਖਿਆ ਜਾਂਦਾ ਹੈ ਫਿਰ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੇਖ ਰੇਖ ਕਰਕੇ ਉਹਨਾਂ ਦੀਆਂ ਕਈ ਚੀਜ਼ਾਂ ਦਾ ਫ਼ਾਇਦਾ ਵੀ ਲੈਂਦੇ ਹਾਂ ਉਹਦੇ ਵਿੱਚ ਸਾਨੂੰ ਕਈ ਪੈਸੇ ਵੀ ਕਮਾਏ ਜਾਂਦੇ ਹਨ ਫਿਰ ਜਦੋਂ ਸਾਡੀ ਚੰਗੀ ਤਰ੍ਹਾਂ ਕਦੇ ਵੀ ਕੋਈ ਜਾਨਵਰ ਨੂੰ ਕਦੇ ਦਿੱਕਤ ਕੋਈ ਪੈ ਜਾਂਦੀ ਆ ਫਿਰ ਅਸੀਂ ਉਹਨੂੰ ਚੰਗੀ ਜਦੋਂ ਆਪਣਾ ਜਾਨਵਰ ਕੋਈ ਆਪਣੇ ਸਾਹ ਪ੍ਰਾਣ ਛੱਡ ਜਾਂਦਾ ਫਿਰ ਅਸੀਂ ਉਸਨੂੰ ਕਸਾਈ ਨੂੰ ਦੇ ਦਿੰਦੇ ਹਾਂ ਫਿਰ ਉਹਨਾਂ ਨੂੰ ਉਹ ਵੀ ਉਹਨਾਂ ਨੂੰ ਉਹਨਾਂ ਦੀ ਵੀ ਵਰਤੋਂ ਕਰਦਾ ਉਹ ਕਿਉਂਕਿ ਉਹਨਾਂ ਦਾ ਚਮੜਾ ਵੀ ਇਹਨਾਂ ਦੇ ਕੰਮ ਆਉਂਦਾ ਹੈ ਫਿਰ ਇਹਨਾਂ ਦੇ ਹੱਡੀਆਂ ਵੀ ਹੱਡੀਆਂ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਵੀ ਜਿਵੇਂ ਉਹਨਾਂ ਸ ਹੱਡੀਆਂ ਚਮੜੇ ਤੋਂ ਨਾ ਜੁੱਤੀਆਂ ਬਣਾਈਆਂ ਜਾਂਦੀਆਂ ਹਨ ਬੈਲਟਾਂ ਬਣਾਈਆਂ ਜਾਂਦੀਆਂ ਹਨ ਔਰ ਹੋਰ ਬਹੁਤ ਸਾਰੀਆਂ ਜੈਕਟਾਂ ਵਗੈਰਾ ਜਿਵੇਂ ਚਾਬੀਆਂ ਦੇ ਛੱਲੇ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਔਰ ਉਹਨਾਂ ਨੂੰ ਬੈਂਗਲਸ ਉਹਨਾਂ ਦੇ ਜਿਹੜੇ ਸਿੰਗ ਹੁੰਦੇ ਆ ਉਹਨਾਂ ਦੇ ਬੈਂਗਲਸ ਦਾ ਔਰ ਕਈ ਚੀਜ਼ਾਂ ਵਿੱਚ ਉਹਨਾਂ ਦਾ ਪਾਊਡਰ ਉਹਦੀ ਵੀ ਵਰਤੋਂ ਕਰ ਸਕਦੇ ਹਾਂ ਫਿਰ ਸਾਨੂੰ ਕਈ ਸਾਰੀਆਂ ਚੀਜ਼ਾਂ ਜੋ ਉਹਨਾਂ ਚੋਂ ਪੈਸਾ ਕਮਾਉਣ ਨੂੰ ਵੀ ਮਿਲਦਾ ਹੈ